ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਹਾਂਜੀ ਪੰਜਾਬ ਦਾ ਤਾਂ ਸਰ ਟਰਾਂਸਪੋਰਟੇਸ਼ਨ ਸਿਸਟਮ ਤਾਂ ਵੈਸੇ ਵਧੀਆ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਐਜ ਏ ਕੋਸਟਲੀ ਆ ਥੋੜ੍ਹਾ ਜਿਹਾ ਪੈਸੇ ਪਰ ਡਿਪੈਂਡ ਆ ਮਤਲਬ ਜਿੰਨੇ ਜ਼ਿਆਦਾ ਤੁਸੀਂ ਪੈਸੇ ਖਰਚੋਂਗੇ ਓਨਾ ਜ਼ਿਆਦਾ ਤੁਸੀਂ ਵਧੀਆ ਫੈਸਿਲਿਟੀ ਮਤਲਬ ਮ ਉਹ ਕਰ ਸਕਦੇ ਹੋ ਇੰਜੋਏ ਕਰ ਸਕਦੇ ਹੋ ਹਾਂਜੀ ਇੱਥੇ ਸਰ ਬਾਏ ਬੱਸ ਤਾਂ ਜੀ ਸਰ ਦੇਖੋ ਨੋਰਮਲੀ ਕਿਰਾਇਆ ਹੈ ਬਾਏ ਬੱਸ ਤੁਸੀਂ ਇੰਜੋਏ ਕਰਦੇ ਜਾਉਂਗੇ ਸਾਰਾ ਪੰਜਾਬ ਤੁਸੀਂ ਆਰਾਮ ਨਾਲ ਘੁੰਮ ਸਕਦੇ ਹੋ ਹਾਂਜੀ ਬਾਕੀ ਬੱਸ 'ਤੇ ਇੱਦਾਂ ਐਂ ਵੀ ਜ਼ਿਆਦਾ ਰੋਡ ਟੁੱਟੇ ਹੋਏ ਨੇ ਬੱਸਾਂ ਲੇਟ ਵਗੈਰਾ ਵੀ ਹੋ ਜਾਂਦੀਆਂ ਕਈ ਵਾਰੀ ਹਾਂਜੀ ਕੋਸਟਲੀ ਤਾਂ ਸਰ ਜ਼ਿਆਦਾ ਨਹੀਂ ਹੈ ਨੋਰਮਲੀ ਕਿਰਾਇਆ ਹੈ ਬਾਕੀ ਤੁਸੀਂ ਇਸ ਤੋਂ ਇਲਾਵਾ ਨਾ ਬਾਏ ਮਤਲਬ ਟਰੇਨ ਤੋਂ ਵੀ ਸਫਰ ਕਰ ਸਕਦੇ ਹੋ ਤੁਸੀਂ ਹਾਂਜੀ ਪੰਜਾਬ ਦੀ ਟਰੇਨ ਸਰ ਨਹੀਂ ਦਿੱਕਤ ਕੋਈ ਨਹੀਂ ਆਉਂਦੀ ਜੀ ਟਰੇਨ ਦੀ ਸਰਵਿਸ ਵੀ ਪ ਨਹੀਂ ਪੰਜਾਬ ਦੀ ਨਾ ਟਰੇਨ ਸਰਵਿਸ ਵੀ ਠੀਕ ਹੈ ਵੈਸੇ ਹਾਂਜੀ ਟਰੇਨ ਸਰਵਿਸ ਇੱਦਾਂ ਹੈ ਟਰੈਫਿਕ ਵਗੈਰਾ ਦਾ ਨਹੀਂ ਸਾਹਮਣਾ ਕਰਨਾ ਪੈਂਦਾ ਆਪਣੀ ਡੈਸਟੀਨੇਸ਼ਨ 'ਤੇ ਨਾ ਜਲਦੀ ਪਹੁੰਚ ਜਾਂਦਾ ਹਾਂਜੀ ਬਾਕੀ ਸਾਫ ਸਫਾਈ ਤਾਂ ਹੁੰਦੀ ਹੋ ਜੀ ਇੱਥੇ ਰੇਲਵੇ ਸਟੇਸ਼ਨਜ ਵਗੈਰਾ 'ਤੇ ਕ ਕੋਈ ਉਹ ਜਗ੍ਹਾ ਕੋਈ ਕੋਈ ਟਾਵੀਂ ਟਾਵੀਂ ਜਗ੍ਹਾ ਇੱਦਾਂ ਦੀ ਹੈ ਜਿੱਥੇ ਥੋੜ੍ਹਾ ਮਤਲਬ ਹਾਈਜੀਨ ਦਾ ਧਿਆਨ ਨਹੀਂ ਰੱਖਿਆ ਜਾਂਦਾ

ਹਾਂਜੀ ਬਾਏ ਏਅਰ ਤਾਂ ਸਰ ਕੋਸਟਲੀ ਪੈ ਜਾਂਦਾ ਮਤਲਬ ਨਾ ਪਰ ਫੈਸਿਲਿਟੀਜ ਹਾਂਜੀ ਬੱਸ ਨਾਲੋਂ ਤਾਂ ਬਹੁਤ ਜ਼ਿਆਦਾ ਪੈ ਜਾਂਦਾ ਹੈ ਬੱਸ ਫੈਸਿਲਿਟੀ ਵੀ ਜ਼ਿਆਦਾ ਹੈ ਜੀ ਬਾਏ ਏਅਰ ਨਾ ਤੁਸੀਂ ਆਪਣੀ ਡੈਸਟੀਨੇਸ਼ਨ 'ਤੇ ਬਹੁਤ ਜਲਦੀ ਪਹੁੰਚ ਸਕਦੇ ਹੋ ਬਹੁਤ ਜ਼ਿਆਦਾ ਸਮਾਂ ਬਚ ਜਾਂਦਾ ਉਹਦੇ ਨਾਲ ਪਰ ਇਹਦਾ ਲੈਕ ਆਫ ਨੌਲੇਜ ਇਹ ਵੀ ਹੈ ਸਰ ਇੱਥੇ ਨਾ ਕਈ ਕਈ ਜਗ੍ਹਾ ਏਅਰਪੋਰਟਸ ਵਗੈਰਾ ਦੀ ਕਮੀ ਹੈ ਉਰੇ ਕਈ ਕੁਝ ਸਿਟੀਆਂ 'ਚ ਹੈ ਨਹੀਂ ਆ ਵੀ ਮੈਂ ਜਿਹੜੇ ਵੱਡੇ ਸ਼ਹਿਰ ਆ ਨਾ ਜਿਹੜੇ ਆਪਣੇ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਹੀ ਆ ਬਸ ਏ ਉਹ ਏਅਰਪੋਰਟਸ ਉਹਦੇ ਕਰਕੇ ਪੈਸੰਜਰਸ ਨੂੰ ਪਹਿਲਾਂ ਤਾਂ ਬੱਸ ਵਗੈਰਾ 'ਤੇ ਹੀ ਜਾਣਾ ਪੈਂਦਾ ਅੱਗੇ ਤੋਂ ਫਿਰ ਏਅਰ ਟਰੈਵਲ ਬੰਦਾ ਕਰ ਸਕਦਾ ਬਾਕੀ ਮੈਂ ਤੁਹਾਨੂੰ ਪ੍ਰੈਫਰ ਕਰੂੰਗਾ ਏਅਰ ਟਰੈਵਲ ਨਾਲੋਂ ਤੁਸੀਂ ਆਪਣਾ ਰੇਲਵੇ ਬੈਸਟ ਹੈ ਮੇਰੇ ਹਿਸਾਬ ਨਾਲ ਤਾਂ ਜੀ ਇਹ 'ਚੋਂ ਜ਼ਿਆਦਾ ਹਾਂਜੀ ਜ਼ਿਆਦਾ ਕੋਸਟਲੀ ਵੀ ਹੈ ਨਹੀਂ ਆ ਫੈਸਲਟੀਜ਼ ਵੀ ਵਧੀਆ ਟਾਈਮ ਵੀ ਬਚਦਾ ਇੱਕ ਦੇਖੋ ਰੋਡ ਅੱਜ ਕੱਲ੍ਹ ਪੰਜਾਬ ਦੇ ਟੁੱਟੇ ਪੁੱਟੇ ਆ ਉਹਨਾਂ ਦਾ ਹਾਂਜੀ ਖੱਡੇ ਪਏ ਆ ਰੋਡਾਂ 'ਤੇ ਉਹਨਾਂ 'ਤੇ ਵੀ ਔਖਾ ਹੁੰਦਾ ਹੈ ਫਿਰ ਟਰੈਵਲ ਕਰਨਾ ਰੇਲਵੇ 'ਚ ਇੱਦਾਂ ਇਹ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇੱਕ ਟਰੈਫਿਕ ਆ ਜੀ ਬਹੁਤ ਵੱਡੀ ਸਮੱਸਿਆ ਪੰਜਾਬ ਦੀ ਜਗ੍ਹਾ ਜਗ੍ਹਾ ਜਾਮ ਲੱਗੇ ਰਹਿੰਦੇ ਆ ਸਰ ਹਾਂਜੀ ਉਹ ਟਰੈਫਿਕ ਕਰਕੇ ਬੰਦਾ ਲੇਟ ਹੋ ਜਾਂਦਾ ਬਹੁਤ ਜ਼ਿਆਦਾ ਇਹ ਰੇਲਵੇ 'ਚ ਇਹ ਆ ਵੀ ਟਾਈਮ ਦੀ ਬਚਤ ਹੁੰਦੀ ਆ ਟਾਈਮ 'ਤੇ ਬੰਦਾ ਪਹੁੰਚ ਜਾਂਦਾ ਜਿੱਥੇ ਜਾਣਾ ਹੋਵੇ ਹਾਂ ਹਾਂਜੀ ਹਾਂਜੀ ਸਰ ਐਨੀ ਟਾਈਮ ਜਦ ਮਰਜ਼ੀ ਹਾਂਜੀ ਹਾਂਜੀ ਕੋਈ ਨਹੀਂ ਓ ਓਕੇ ਜੀ ਓਕੇ ਕੋਈ ਚੱਕਰ